ਰਸੋਈ ਵਿੱਚ ਇੱਕ ਗਲਾਸ ਹੁੰਦਾ ਵਾ ਗਲਾਸ ਨੂੰ ਆਪਾਂ ਪਾਣੀ ਪੀਣ ਲਈ ਵਰਤਦੇ ਹਾਂ ਫਿਰ ਉਹਦੇ ਵਿੱਚ ਇੱਕ ਪਲੇਟ ਹੁੰਦੀ ਆ ਪਲੇਟ ਦੇ ਵਿੱਚ ਆਪਾਂ ਖਾਣਾ ਖਾਂਦੇ ਹਾਂ ਇੱਕ ਚਮਚ ਹੁੰਦਾ ਵਾ ਚਮਚ ਆਪਾਂ ਮਤਲਬ ਕੋਈ ਵੀ ਚੀਜ਼ ਸਬਜ਼ੀ ਨੂੰ ਖਾਣ ਦੇ ਲਈ ਵਰਤਦੇ ਹਾਂ ਫਿਰ ਇੱਕ ਪਰਾਤ ਹੁੰਦੀ ਆ ਪਰਾਤ ਆਪਾਂ ਆਟਾ ਗੁੰਨਣ ਲਈ ਵਰਤਦੇ ਹਾਂ ਫਿਰ ਰਸੋਈ ਦੇ ਵਿੱਚ ਇੱਕ ਕੜਾਹੀ ਹੁੰਦੀ ਆ ਕੜਾਹੀ ਨੂੰ ਆਪਾਂ ਪਹਿਲਾਂ ਉਹਦੇ ਵਿੱਚ ਆਪਾਂ ਤੜਕਾ ਲਾਉਂਦੇ ਹਾਂ ਫਿਰ ਤੜਕਾ ਲਾਉਣ ਤੋਂ ਬਾਅਦ ਆਪਾਂ ਜਿਹੜੀ ਵੀ ਸਬਜ਼ੀ ਬਣਾਉਣੀ ਹੁੰਦੀ ਆ ਉਹਨੂੰ ਆਪਾਂ ਬਣਾ ਲੈਂਦੇ ਹਾਂ ਫਿਰ ਇੱਕ ਕੁੱਕਰ ਹੁੰਦਾ ਵਾ ਕੁੱਕਰ ਦੇ ਵਿੱਚ ਆਪਾਂ ਕੁਛ ਵੀ ਮਤਲਬ ਕਿ ਬਣਾਉਣਾ ਹੁੰਦਾ ਵਾ ਮਤਲਬ ਉਬਾਲਣਾ ਹੁੰਦਾ ਵਾ ਉਹਦੇ ਲਈ ਆਪਾਂ ਕੁੱਕਰ ਵਰਤਦੇ ਹਾਂ ਜਿਵੇਂ ਆਪਾਂ ਆਲੂ ਉਬਾਲਣੇ ਹੁੰਦੇ ਆ ਜਾਂ ਫਿਰ ਕੁਝ ਹੋਰ ਵੀ ਉਬਾਲਣਾ ਹੁੰਦਾ ਉਹਦੇ ਲਈ ਆਪਾਂ ਵਰਤਦੇ ਹਾਂ